ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਅਰੁਣਾ ਬੋਲ ਰਹੀ ਹਾਂ ਜੀ ਸਾਡੇ ਇੱਥੇ ਅਤੇ ਜਿਹੜੇ ਧਰਤੀ ਉੱਤੇ ਹੈ ਵਾ ਇੱਥੇ ਹੀ ਹੈ ਜੀਵਨ ਹੋਰ ਮੰਗਲ ਗ੍ਰਹਿ ਸੂਰਜ ਗ੍ਰਹਿ ਚੰਦਰਮਾ ਗ੍ਰਹਿ ਉੱਥੇ ਕੋਈ ਨਹੀਂ ਜੀਵਨ ਹੈਗਾ ਉੱਥੇ ਕੋਈ ਰਹਿੰਦਾ ਨਹੀਂ ਹੈ ਇੱਥੇ ਰਹਿੰਦੇ ਹੈ ਇੱਥੇ ਹੀ ਜੰਮਦੇ ਹੈ ਇੱਥੇ ਹੀ ਮਰ ਜਾਂਦੇ ਆ ਇੱਥੇ ਹੀ ਹੈਗੇ ਆ ਵੀ ਇੱਥੇ ਪਾਣੀ ਹੈ ਇੱਥੇ ਹੀ ਹਵਾ ਇੱਥੇ ਹੀ ਕਿੰਨਾ ਨਹੀਂ ਸਾਰਾ ਕੁਛ ਇੱਥੇ ਹੀ ਆ ਅਤੇ ਇੱਥੇ ਹੀ ਜਿਉਂਦੇ ਹੈ ਅਤੇ ਇੱਥੇ ਮਰ ਜਾਂਦੇ ਆ ਹੋਰ ਚੰਦਰਮਾ ਗ੍ਰਹਿ 'ਤੇ ਨਹੀਂ ਉੱਥੇ ਵੀ ਸਾਡੇ ਸਾਇੰਸ ਵਾਲੇ ਗਏ ਦੇ ਸੀ ਉਹ ਵੀ ਕਹਿੰਦੇ ਵੀ ਉੱਥੇ ਰਹਿ ਨਹੀਂ ਸਕਦੇ ਉੱਥੇ ਨਹੀਂ ਰਹਿ ਸਕਦੇ ਬਸ ਇਹ ਵਾ ਵੀ ਉੱਥੇ ਪੱਥਰੀਲਾ ਇਲਾਕਾ ਵਾ ਉੱਥੇ ਨਹੀਂ ਰਹਿ ਸਕਦੇ ਇੱਥੇ ਹੀ ਰਹਿ ਸਕਦੇ ਆ ਕਿਉਂਕਿ ਇੱਥੇ ਹੀ ਸਾਰਾ ਕੁਛ ਹੈਗਾ ਵਾ ਇੱਥੇ ਇੱਥੇ ਹੀ ਸਾਰਾ ਕਰਤਾ ਪਿਆ ਚੱਕਰ ਸਾਰਾ ਇੱਥੇ ਹੀ ਚੱਲਦਾ ਉੱਥੇ ਕਿੰਨਾ ਨਹੀਂ ਪੱਥਰ ਹੀ ਹੈ ਵਾ ਧਰਤੀ ਉੱਤੇ ਸਾਰਾ ਕੁਛ ਇੱਥੇ ਪਾਣੀ ਅਤੇ ਧਰਤੀ 'ਤੇ ਹੀ ਅਤੇ ਹਵਾ ਪਾਣੀ ਸਾਰਾ ਕੁਛ ਇੱਥੇ ਹੀ ਹੈ ਇੱਥੇ ਹੀ ਜੰਮਦੇ ਹੈ ਇੱਥੇ ਹੀ ਮਰ ਜਾਂਦੇ ਹੈ